ਤਕਨੋਲਜੀ ਨੇ ਸਿੱਖਿਆ ਉਦਯੋਗ ਵਿੱਚ ਬਹੁਤ ਵੱਡੀ ਕ੍ਰਾਂਤੀ ਲਿਆਂਦੀ ਹੈ ਜਿਸ ਤਰ੍ਹਾਂ ਕਿ ਕਈ ਪੇਂਡੂ ਖੇਤਰ ਦੇ ਬੱਚੇ ਸੀ ਜਿਨਾਂ ਨੂੰ ਕਈ ਵਾਰ ਜਿਵੇਂ ਕਰੋਨਾ ਕਾਲ ਆ ਗਿਆ ਜਾਂ ਹੋਰ ਆ ਉਹਨਾਂ ਨੂੰ ਟਿਊਸ਼ਨ ਵਗੈਰਾ ਨਹੀਂ ਹੋ ਪਾਉਂਦੇ ਸੀ ਜਾਂ ਸਕੂਲ ਨਹੀਂ ਜਾ ਪਾਉਂਦੇ ਉਹ ਤਾਂ ਉਹ ਤਕਨੋਲੋਜੀ ਦੇ ਮਾਧਿਅਮ ਰਾਹੀਂ ਯੂਟੀਊਬ ਦੇ ਮਾਧਿਅਮ ਦੇ ਰਾਹੀ ਬਹੁਤ ਸਿੱਖਿਆ ਪ੍ਰਾਪਤ ਕਰ ਰਹੇ ਨੇ ਤੇ ਉਹ ਬੱਚੇ ਆਪਣੇ ਖੇਤਰ ਦੇ ਵਿੱਚ ਅੱਗੇ ਵੱਧ ਰਹੇ ਨੇ ਜਿਵੇਂ ਕਿ ਬੱਚਿਆਂ ਨੂੰ ਕਈ ਵਾਰ ਜਿਵੇਂ ਪਹਿਲਾਂ ਆਪਾਂ ਗੱਲ ਕਰ ਚੁੱਕੇ ਆ ਵੀ ਕਰੋਨਾ ਆ ਗਿਆ ਸੀ ਉਸ ਤਰ੍ਹਾਂ ਹੁਣ ਟੈਕਨੋਲਜੀ ਦੇ ਨਾਲ ਹੀ ਹੋ ਸਕਿਆ ਵੀ ਉਹਨਾਂ ਦੀ ਸਟਡੀ ਰੈਗੂਲਰ ਰਹੀ ਆ ਜਿਵੇਂ ਯੂਟੀਊਬ ਤੇ ਜੂਮ ਕਲਾਸ ਲਾਉਣੀ ਆ ਯੂਟੀਊਬ 'ਤੇ ਵੀਡੀਓ ਬਣਾ ਕੇ ਭੇਜਣੀਆਂ ਤੇ ਇੱਕ ਹੋਰ ਸਾਰਿਆਂ ਨਾਲੋਂ ਵੱਡੀ ਗੱਲ ਆ ਵਿਸ਼ਵ ਦੇ ਆਪਾਂ ਕੋਈ ਵੀ ਹਿਸਟਰੀ ਨੂੰ ਟੈਕਨੋਲੋਜੀ ਜਰੀਏ ਦੇਖ ਸਕਦੇ ਹਾਂ ਕਿਸੇ ਵੀ ਦੇਸ਼ ਦੇ ਵਿੱਚ ਵੀਡੀਓ ਕਾਲ ਕਰਕੇ ਆਪਣਾ ਘਰ ਵਗੈਰਾ ਆਪਣਾ ਕਾਰੋਬਗੈਰ ਵਗੈਰਾ ਇਹ ਵੀ ਆਪਾਂ ਤਕਨਾਲੋਜੀ ਦੇ ਜਰੀਏ ਚੈੱਕ ਕਰ ਸਕਦੇ ਆ ਤਕਨੋਲੋਜੀ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਇਸ ਗੱਲ ਦੇ ਵਿੱਚ ਜਿਵੇਂ ਆਪਾਂ ਕੋਈ ਵੀ ਲਾਇਬਰੇਰੀ ਦੀ ਬੁੱਕ ਪੜਦੇ ਆ ਜਿਹੜੇ ਆਪਾਂ ਨੂੰ ਨਹੀਂ ਮਿਲਦੀ ਕਿਸੇ ਵੀ ਦੇਸ਼ ਦੀ ਜਾਂ ਹੋਰ ਯੂਨੀਵਰਸਟੀ ਆਪਣੀ ਲਾਈਬ੍ਰੇਰੀ ਦੇ ਵਿੱਚ ਨਹੀਂ ਹੈਗੀ ਲੋਕਲ ਵਾਲੀ 'ਚ ਤਾਂ ਆਪਾਂ ਯੂ ਇਹਨੂੰ ਔਨਲਾਈਨ ਪੜ ਸਕਦੇ ਆ ਰੀਡ ਕਰ ਸਕਦੇ ਆਂ ਜਾਂ ਔਨਲਾਈਨ ਮੰਗਵਾ ਸਕਦੇ ਆ ਟੈਕਨੋਲਜੀ ਜਿਥੇ ਇਹਦੇ ਮਾੜੇ ਪ੍ਰਭਾਵ ਪੈਂਦੇ ਨੇ ਸਿੱਖਿਆ ਦੇ ਵਿੱਚ ਜਿਵੇਂ ਪਰ ਇਹਦੇ ਚੰਗੇ ਜਿਆਦੇ ਨੇ ਮਾੜੇ ਨਾਲੋ ਜਿਵੇਂ ਆਪਾਂ ਕਹਿ ਸਕਦੇ ਆਂ ਕਿਉਂਕਿ ਹਰੇਕ ਬੰਦੇ ਦੀ ਨੌਲੇਜ ਦੇ ਵਿੱਚ ਵਾਧਾ ਕੀਤਾ ਇਹਨੇ ਤੇ ਕਿਤੇ ਵੀ ਕੋਈ ਅਫਵਾਹ ਫੈਲਾਉਂਦਾ ਤਾਂ ਇੱਕ ਮਿੰਟ 'ਚ ਪਤਾ ਲੱਗਾ ਉਹ ਤੈਕਨੋਲੋਜੀ ਦੇ ਜਰੀਏ ਪਤਾ ਲੱਗ ਜਾਂਦਾ ਗੱਲ ਗਲਤ ਜਾਂ ਠੀਕ ਕੋਈ ਵੀ ਇਨਫੋਰਮੇਸ਼ਨ ਆ ਲੋਕਾਂ ਤੱਕ ਜਲਦੀ ਪ ਪਹੁੰਚ ਜਾਂਦੀ ਹੈ ਕੋਈ ਮੌਸਮ ਖਰਾਬ ਹੈ ਜਾਂ ਕੋਈ ਸਟੱਡੀ ਦੇ ਵਿੱਚ ਚੇਂਜ ਹੋਇਆ ਜਾ ਕੋਈ ਸਿਲੇਬਸ ਚੇਂਜ ਹੋਇਆ ਕੁਛ ਵੀ ਆ ਸਟੱਡੀ ਦੇ ਮਾਮਲੇ ਨੇ ਲੋਕਾਂ ਨੂੰ ਬਹੁਤ ਜਾਗਰੂਕਤ ਕੀਤਾ ਹੈ